ਸਤਿ ਸ਼੍ਰੀ ਅਕਾਲ ਜੀ ਅਗਰ ਆਪਾਂ ਗੱਲ ਕਰੀਏ ਪ੍ਰਾਚੀਨ ਕਾਲ 'ਤੇ ਅਤੇ ਮੱਧ ਕਾਲੀਨ ਦੇ ਮਹਾਨ ਰਾਜਿਆਂ ਬਾਰੇ ਤਾਂ ਮੈਂ ਸਭ ਤੋਂ ਪਹਿਲਾਂ ਪ੍ਰਾਚੀਨ ਕਾਲ ਵਿੱਚ ਹੋਏ ਮਹਾਨ ਰਾਜੇ ਜਨਕਪੁਰ ਦੇ ਮਹਾਰਾਜਾ ਰਾਜਾ ਜਨਕ ਜੀ ਦੀ ਗੱਲ ਕਰਾਂਗਾ ਉਨ੍ਹਾਂ ਦੇ ਮਨ ਵਿੱਚ ਆਪਣੀ ਪ੍ਰਜਾ ਨੂੰ ਲੈ ਕਰਕੇ ਇੰਨਾ ਪਿਆਰ ਇੰਨਾ ਸਨੇਹ ਅਤੇ ਇੰਨਾ ਸਮਰਪਣ ਸੀ ਕਿ ਉਨ੍ਹਾਂ ਦੇ ਰਾਜ ਵਿੱਚ ਜਦੋਂ ਅਕਾਲ ਪਿਆ ਲੋਕ ਪਿਆਸੇ ਭੁੱਖੇ ਮਰਨ ਲੱਗੇ ਪਸ਼ੂ ਵੀ ਆਪਣੇ ਪ੍ਰਾਣ ਤਿਆਗਣ ਲੱਗੇ ਤਾਂ ਉਨ੍ਹਾਂ ਨੂੰ ਦੇਵਯੋਗ ਨਾਲ ਇੱਕ ਹੱਲ ਨਿਕਲਿਆ ਹੱਲ ਬਾਰੇ ਪਤਾ ਚੱਲਿਆ ਕਿ ਅਗਰ ਰਾਜਾ ਜਨਕ ਖੁਦ ਖੇਤਾਂ ਵਿੱਚ ਸੋਨੇ ਦਾ ਹਲ਼ ਜੋਤਣ ਤਾਂ ਅਕਾਲ ਦੂਰ ਹੋ ਸਕਦਾ ਹੈ ਅਗਰ ਦੇਖਿਆ ਜਾਵੇ ਇੱਕ ਰਾਜਾ ਸਧਾਰਨ ਕਿਸਾਨ ਵਾਂਗ ਖੇਤਾਂ ਵਿੱਚ ਹਲ਼ ਜੋਤਣਾ ਕਿਉਂ ਸਵੀਕਾਰ ਕਰੇਗਾ ਲੇਕਿਨ ਜਦੋਂ ਦੇਖਿਆ ਕਿ ਪ੍ਰਜਾ ਨੂੰ ਇਸ ਨਾਲ ਸੁੱਖ ਮਿਲੂ ਤਾਂ ਰਾਜਾ ਜਨਕ ਜੀ ਨੇ ਕਿਸਾਨ ਬਣਨਾ ਸਵੀਕਾਰ ਕੀਤਾ ਇਹ ਤਾਂ ਹੋਏ ਸਾਡੇ ਪ੍ਰਾਚੀਨ ਯੁੱਗ ਦੇ ਰਾਜਾ ਰਾਜਾ ਜਨਕ ਅਗਰ ਮੱਧਕਾਲੀਨ ਵਿੱਚ ਆਪਾਂ ਚਰਚਾ ਕਰੀਏ ਤਾਂ ਸਮਰਾਟ ਅਸ਼ੋਕ ਜੀ ਦੀ ਚਰਚਾ ਆਪਾਂ ਕਰ ਸਕਦੇ ਹਾਂ ਜਾਂ ਫਿਰ ਚੰਦਰਗੁਪਤ ਮੌਰੀਆ ਜਿਨ੍ਹਾਂ ਨੇ ਮੌਰੀਆ ਵੰਸ਼ ਚਲਾਇਆ ਮੌਰੀਆ ਵੰਸ਼ ਦੀ ਸ਼ੁਰੂਆਤ ਨੰਦ ਵੰਸ਼ ਨੂੰ ਸਮਾਪਤ ਕਰਨ ਤੋਂ ਬਾਅਦ ਹੋਈ ਨੰਦ ਵੰਸ਼ ਤੁਸੀਂ ਜਾਣਦੇ ਹੋ ਅਗਰ ਇਤਿਹਾਸ ਦੇ ਝਰੋਖਿਆਂ ਵਿੱਚ ਦੇਖੋਗੇ ਤਾਂ ਗਰੀਬਾਂ 'ਤੇ ਅੱਤਿਆਚਾਰ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਾ ਮਾਰਨਾ ਨਾਰੀਆਂ ਦਾ ਅਪਮਾਨ ਕਰਨਾ ਇੱਥੋਂ ਤੱਕ ਕਿ ਬਲਾਤਕਾਰ ਵੀ ਕਰਨਾ ਇਹੋ ਚੱਲ ਰਿਹਾ ਸੀ ਅਤੇ ਦੇਸ਼ ਬਾਰੇ ਸਮਾਜ ਬਾਰੇ ਕੋਈ ਧਿਆਨ ਨਹੀਂ ਸੀ ਕੋਈ ਉਨ੍ਹਾਂ ਦੀ ਸੁਰਕਸ਼ਾ ਦਾ ਉਨ੍ਹਾਂ ਦੇ ਸਨਮਾਨ ਦਾ ਕੋਈ ਖਿਆਲ ਨਹੀਂ ਸੀ ਫਿਰ ਚਾਣਕਿਆ ਜੋ ਇੱਕ ਮਹਾਨ ਵਿਦਵਾਨ ਅਧਿਆਪਕ ਹੋਏ ਉਨ੍ਹਾਂ ਨੇ ਤਕਸ਼ਲਾ ਤੋਂ ਬਾਹਰ ਆ ਕੇ ਐਸੀ ਖੋਜ ਕੀਤੀ ਕੀ ਕੋਈ ਐਸੇ ਵਿਅਕਤੀ ਨੂੰ ਰਾਜਾ ਬਣਾਇਆ ਜਾਵੇ ਜੋ ਨੰਦ ਦੀ ਕੁਰਸੀ ਨੂੰ ਇੱਕ ਐਸੇ ਅਸਥਾਨ 'ਤੇ ਪਹੁੰਚਾਵੇ ਜੋ ਅਸਥਾਨ ਪੂਜਨੀਏ ਹੋ ਜਾਏ ਅਤੇ ਚਾਣਕਿਆ ਨੇ ਆਚਾਰਿਆ ਚਾਣਕਿਆ ਨੇ ਉਨ੍ਹਾਂ ਨੂੰ ਟ੍ਰੇਨਡ ਕੀਤਾ ਸਿਕਸ਼ਾ ਦਿਕਸ਼ਾ ਦਿੱਤੀ ਚੰਦਰਗੁਪਤ ਨੂੰ ਅਤੇ ਉਨ੍ਹਾਂ ਦੀ ਕੁਰਸੀ 'ਤੇ ਉਨ੍ਹਾਂ ਨੂੰ ਸਿੰਘਾਸਣ 'ਤੇ ਬਿਠਾਇਆ ਅਤੇ ਸਾਡੇ ਭਾਰਤ ਦਾ ਗੋਲਡਨ ਪੀਰਡ ਸਵਰਣਮੀ ਯੁੱਗ ਕਿਹਾ ਜਾਂਦਾ ਹੈ ਜੋ ਮੌਰੀਆ ਕਾਲ ਹੈ ਆਪਾਂ ਸਮਰਾਟ ਅਸ਼ੋਕ ਬਾਰੇ ਵੀ ਗੱਲ ਕਰ ਸਕਦੇ ਹਾਂ ਜਿਨ੍ਹਾਂ ਨੇ ਬਹੁਤ ਅੱਤਿਆਚਾਰ ਕੀਤੇ ਸਭ ਕੁਛ ਕੀਤਾ ਲੇਕਿਨ ਕਲਿੰਗ ਦਾ ਇੱਕ ਯੁੱਧ ਹੋਇਆ ਉਸ ਯੁੱਧ ਵਿੱਚ ਜਦੋਂ ਉਨ੍ਹਾਂ ਨੇ ਇੰਨੀਆਂ ਮੌਤਾਂ ਦੇਖੀਆਂ ਲਾਸ਼ਾਂ ਦੇਖੀਆਂ ਤਾਂ ਉਨ੍ਹਾਂ ਨੂੰ ਮਹਾਤਮਾ ਬੁੱਧ ਦੀ ਸ਼ਿਸ਼ਿਐ ਪਰੰਪਰਾ 'ਚੋਂ ਉਕਤ ਗੁਪਤ ਨਾਮ ਦੇ ਇੱਕ ਜੋ ਬੋਧੀ ਮਿਲੇ ਉਨ੍ਹਾਂ ਨੇ ਉਨ੍ਹਾਂ ਨੂੰ ਝੰਜੋੜਿਆ ਕਿ ਕੀ ਤੇਰਾ ਜੀਵਨ ਦਾ ਲਕਸ਼ ਇਹੀ ਸੀ ਤਾਂ ਉਨ੍ਹਾਂ ਨੂੰ ਆਂਤਰਿਕ ਜਾਗਰੂਕਤਾ ਹੋਈ ਉਨ੍ਹਾਂ ਨੇ ਸਿਕਸ਼ਾ ਦਿਕਸ਼ਾ ਪ੍ਰਾਪਤ ਕੀਤੀ ਅਤੇ ਸਮਰਾਟ ਅਸ਼ੋਕ ਹਿੰਸਾ ਤਿਆਗ ਕੇ ਅਹਿੰਸਾ ਦੇ ਮਾਰਗ 'ਤੇ ਚੱਲੇ ਅਤੇ ਸਮਾਜ ਨੂੰ ਇੱਕ ਨਵੀਂ ਉਚਾਈਆਂ 'ਤੇ ਲੈ ਕੇ ਚੱਲੇ ਪਹੁੰਚੇ ਧੰਨਵਾਦ